ਹਾਂਜੀ ਮੈਂ ਨਾ ਸਵੈਟਰ ਬਹੁਤ ਬਣਾਉਂਦੀ ਹਾਂ ਮੈਨੂੰ ਨਾ ਸਵੈਟਰ ਬੁਣਨਾ ਬਹੁਤ ਪਸੰਦ ਹੈ ਮੈਂ ਨਾ ਆਪਣੀ ਭੈਣ ਨੂੰ ਵੀ ਭੈਣ ਦੇ ਬੱਚਿਆਂ ਨੂੰ ਵੀ ਬਹੁਤ ਸਵੈਟਰ ਬਣਾ ਬਣਾ ਕੇ ਦਿੱਤੇ ਆ ਸਾਰੇ ਕਹਿੰਦੇ ਆ ਵੀ ਬਹੁਤ ਵੜੀਆ ਵਧੀਆ ਬਨਾਉਂਦੀ ਹੈ ਅਤੇ ਮੈਂ ਸੂਟ ਵੀ ਸਿਲ ਲੈਂਦੀ ਹਾਂ ਅਤੇ ਇੱਕ ਵਾਰੀ ਮੈਂ ਆਪਣੇ ਇੱਥੇ ਕਿਸੇ ਨੂੰ ਨੂ ਟੋਪੇ ਬਣਾ ਕੇ ਦਿੱਤੇ ਸੀ ਉਹ ਸਾਰੇ ਪੁੱਛ ਰਹੇ ਸੀ ਵੀ ਕਿਹਨੇ ਬਣਾਏ ਕਿਹਨੇ ਬਣਾਇਆ ਮੈਨੂੰ ਬਹੁਤ ਚੰਗਾ ਲੱਗਦਾ ਜਿਵੇਂ ਕੋਈ ਫੀਡਬੈਕ ਦੇਵੇ ਨਾ ਮੈਨੂੰ ਬਹੁਤ ਵਧੀਆ ਲੱਗਦਾ ਹੁਣ ਸਾਡਾ ਨਾ ਉਤਸ਼ਾਹ ਵੱਧਦਾ ਵੀ ਹੋਰ ਬਣਾਈਏ ਹੋਰ ਬਣਾਈਏ ਔਰ ਕਿਆ ਕਹਿੰਦੇ ਮੈਂ ਮਤਲਬ ਬਹੁਤ ਮੈਨੂੰ ਨਾ ਮਨ ਕਰਦਾ ਵੀ ਮੈਂ ਆਪਣੀ ਕੋਈ ਮਤਲਬ ਦੁਕਾਨ ਖੋਲ੍ਹ ਕੇ ਬਹਿ ਜਾਵਾਂ ਵੀ ਜਿੱਦਾਂ ਕਿ ਸਾਰੇ ਟੋਪੀ ਸਵੈਟਰ ਦੇ ਸੂਟ ਦੇ ਬੂਟੀਕ ਖੋਲ੍ਹ ਕੇ ਬਹਿ ਜਾ ਹੈ ਨਾ ਔਰ ਕਿਆ ਕਹਿੰਦੇ ਵੀ ਮਤਲਬ ਮੈਨੂੰ ਨਾ ਮਤਲਬ ਮਜ਼ਾ ਆਉਂਦਾ ਹੈ ਨਾ ਮੈਨੂੰ ਸਵੈਟਰ ਬਣਾਉਣ 'ਚ ਹੋਰ ਕਿਸੇ ਚੀਜ਼ ਵਿੱਚ ਮੈਨੂੰ ਇੰਨਾ ਮਜ਼ਾ ਨਹੀਂ ਆਉਂਦਾ ਜਿੱਦਾਂ ਕਿ ਸਵੈਟਰ ਬੁਣ ਕੇ ਮਜ਼ਾ ਆਉਂਦਾ ਹੈ ਮੈਨੂੰ